ਅੱਠ ਦਸ ਦੋ ਹਜ਼ਾਰ ਨੌਂ ਸੌਲਾਂ ਨਵੰਬਰ ਦੋ ਹਜ਼ਾਰ ਸਤਾਰਾਂ ਇੱਕ ਫਰਵਰੀ ਉੱਨੀ ਸੌ ਤਰਾਸੀ ਤਿੰਨ ਜੂਨ ਉੱਨੀ ਸੌ ਸਤਾਸੀ ਤੀਹ ਨਵੰਬਰ ਦੋ ਹਜ਼ਾਰ ਅੱਠ